ਅੱਠ ਅਪ੍ਰੈਲ ਦੋ ਹਜ਼ਾਰ ਸੌਲ੍ਹਾਂ ਉਨੀ ਨਵੰਬਰ ਦੋ ਹਜ਼ਾਰ ਬਾਈ ਸਤਾਰਾਂ ਸਤੰਬਰ ਦੋ ਹਜ਼ਾਰ ਇੱਕੀ ਪੰਦਰਾਂ ਫਰਵਰੀ ਦੋ ਹਜ਼ਾਰ ਉੱਨੀ ਤੇਈ ਜੂਨ ਦੋ ਹਜ਼ਾਰ ਤੇਈ